ਮੇਰੇ ਮੁਤਾਬਕ ਖੇਡ ਇੱਕ ਇਹੋ ਜਿਹੀ ਚੀਜ਼ ਹੈ ਜੋ ਹਰ ਬੰਦੇ ਨੂੰ ਖੇਡਣੀ ਚਾਹੀਦੀ ਹੈ ਇਸ ਨਾਲ ਬੰਦਾ ਨਰੋਇਆ ਅਤੇ ਤੰਦਰੁਸਤ ਰਹਿੰਦਾ ਹੈ ਮੈਂ ਇੱਕ ਐਥਲੈਟਿਕਸ ਗੇਮ ਦਾ ਖਿਡਾਰੀ ਹਾਂ ਮੈਂ ਹੰਡਰਡ ਮੀਟਰ ਰੇਸ ਦੌੜਦਾ ਹਾਂ ਇਸ ਨੂੰ ਦੌੜਦੇ ਹੋਏ ਮੈਨੂੰ ਤਿੰਨ ਕੁ ਸਾਲ ਹੋ ਗਏ ਹਨ ਮੈਂ ਦੌ ਰੋਜ਼ਾਨਾ ਸਟੇਡੀਅਮ ਜਾ ਕੇ ਗਰਾਉਂਡ ਵਿੱਚ ਪ੍ਰੈਕਟਿਸ ਕਰਦਾ ਹਾਂ ਅਤੇ ਦੋ ਘੰਟੇ ਉੱਥੇ ਬਤੀਤ ਕਰਨ ਤੋਂ ਬਾਅਦ ਹੀ ਘਰ ਪਹੁੰਚਦਾ ਹਾਂ ਗਰਾਉਂਡ 'ਚ ਪ੍ਰੈਕਟਿਸ ਕਰਨ ਦੇ ਦੌਰਾਨ ਸਾਰਿਆਂ ਨੂੰ ਮੈਂ ਪ੍ਰੇਰਿਤ ਵੀ ਕਰਦਾ ਹਾਂ ਕਿ ਇਸ ਗੇਮ ਵੱਲ ਧਿਆਨ ਦੇਵੋ ਅਤੇ ਇਸ ਨਾਲ ਖੇਡਣ ਵੇਲੇ ਵੀ ਬਹੁਤ ਇਹਤਿਆਤ ਨਾਲ ਖੇਡੋ ਇਸ ਨੂੰ ਬਹੁਤ ਚੁਸਤੀ ਨਾਲ ਖੇਡਿਆ ਜਾਂਦਾ ਹੈ ਜੇਕਰ ਮੈਨੂੰ ਇਸ ਨਗੇਮ ਨੂੰ ਹੋਰ ਸਿੱਖਣ ਦਾ ਮੌਕਾ ਮਿਲੇ ਤਾਂ ਮੈਂ ਹੋਰ ਸਿੱਖਣ ਦੀ ਕੋਸ਼ਿਸ਼ ਕਰਾਂਗਾ ਮੈਂ ਹੋਰ ਜਿੱਦਾਂ ਕਿ ਸਟੇਟ ਲੈਵਲ ਨੈਸ਼ਨਲ ਲੈਵਲ ਤੱਕ ਜਾਣ ਦੀ ਵੀ ਪ੍ਰੇਰਿਤ ਕਰੂੰਗਾ ਅਤੇ ਉਸਨੂੰ ਕੋਸ਼ਿਸ਼ ਕਰੂੰਗਾ ਕਿ ਮੈਂ ਉਸ ਮੁਕਾਮ ਤੱਕ ਪਹੁੰਚ ਸਕਾਂ